ਮੇਰੇ ਕੋਲ ਕੋਈ ਵੀ ਸਿਹਤ ਸੰਭਾਲ ਬੀਮਾ ਨਹੀਂ ਹੈ ਪਰ ਮੇਰੇ ਫਾਦਰ ਸਾਹਿਬ ਕੋਲ ਇਨ ਮਤਲਬ ਉਹਨਾਂ ਕੋਲ ਇੱਕ ਐੱਲ ਆਈ ਸੀ ਦਾ ਸਿਹਤ ਸੰਭਾਲ ਬੀਮਾ ਹੈ ਜੋ ਕਿ ਸਾਨੂੰ ਪੰਜ ਤੋਂ ਦਸ ਲੱਖ ਦੀ ਸਿਹਤ ਬੀਮੇ ਦੇ ਛੂਟ ਦਿੰਦਾ ਹੈ ਹਾਲੇ ਹਾਲਾਂ ਮਤਲਬ ਉਹ 'ਚ ਹਾਲਾਂ ਤਾਂ ਉਹਦੀ ਲੋੜ ਨਹੀਂ ਪਈ ਬਟ ਇਨ ਫਿਊਚਰ ਅਗਰ ਉਹਦੀ ਕਦੇ ਲੋੜ ਨਾ ਰੱਬ ਕਰੇ ਪਵੇ ਤਾਂ ਉਹ ਸਾਨੂੰ ਪੂਰੀ ਸਪੋਰਟ ਕਰੂਗਾ